ਭਾਰਤ ਵਿੱਚ ਸਭ ਤੋਂ ਪ੍ਰਸਿੱਧ ਖੇਡਾਂ ਕ੍ਰਿਕਟ ਵੋਲੀਬੋਲ ਬਾਸਕੀਟਬੋਲ ਬੈਡਮਿੰਟਨ ਹੋਕੀ ਅਤੇ ਬਹੁਤ ਸਾਰੀਆਂ ਹਨ ਪਰ ਸਭ ਤੋਂ ਮੈਨੂੰ ਕ੍ਰਿਕ ਖੇਡਾਂ ਦੇਖਣ ਦਾ ਬਹੁਤ ਸ਼ੌਂਕ ਹੈ ਅਤੇ ਮੇਰੀ ਫੇ ਜੋ ਸਭ ਤੋਂ ਫੇਵਰੇਟ ਹੈਗੀ ਆ ਉਹ ਹੈਗੀ ਕ੍ਰਿਕਟ ਮੈਂ ਕ੍ਰਿਕਟ ਕਾਫ਼ੀ ਟਾਈਮ ਤੋਂ ਦੇਖਦੀ ਆ ਰਹੀ ਮੈਂ ਟੀ ਵੀ 'ਤੇ ਵੀ ਕੋਈ ਵੀ ਆਈ ਪੀ ਐੱਲ ਦਾ ਆਉਂਦਾ ਹੈ ਟਵੈਂਟੀ ਟਵੈਂਟੀ ਆਉਂਦਾ ਹੈ ਏਸ਼ੀਆ ਕੱਪ ਦਾ ਆਉਂਦਾ ਵਰਲਡ ਕੱਪ ਮੈਂ ਬਹੁਤ ਵਧੀਆ ਦੇਖਦੀ ਹਾਂ ਅਤੇ ਬਹੁਤ ਮੈਨੂੰ ਇੰਟਰਸਟ ਹੈਗਾ ਉਹ ਚੀਜ਼ਾਂ ਵਿੱਚ ਦੇਖਣ ਦਾ ਕ੍ਰਿਕਟ ਮੇਰੀ ਸਭ ਤੋਂ ਫੇਵਰਟ ਹੌਬੀ ਹੈਗੀ ਆ ਅਤੇ ਦੇਸ਼ ਦੇ ਸਭ ਤੋਂ ਮਸ਼ਹੂਰ ਜਿਹੜੇ ਐਥਲੀਟ ਹੈਗੇ ਹੈ ਉਹ ਨੀਰਜ ਚੌਪੜਾ ਹੈਗਾ ਮੈਰੀ ਕੌਮ ਹੈਗਾ ਪੀ ਵੀ ਸਿੱਧੂ ਹੈਗਾ ਅਤੇ ਮਿਲਖਾ ਸਿੰਘ ਹੈਗੇ ਆ ਇਹ ਬੜੇ ਮਤਲਬ ਮਸ਼ਹੂਰ ਹੈਗੇ ਆ ਇਹਦੇ ਐਥਲੀਟ 'ਚ ਅਤੇ ਗ ਗੇਮਸ ਵਿੱਚ ਬੈਡਮਿੰਟਨ ਵੀ ਖੇਡਣ ਦਾ ਮੈਨੂੰ ਬਹੁਤ ਸ਼ੌਂਕ ਹੈਗਾ ਅਤੇ ਬੈਡਮਿੰਟਨ ਵੀ ਬੜੀ ਵਧੀਆ ਲੱਗਦਾ ਹੈ ਅਤੇ ਕ੍ਰਿਕਟ ਵੀ ਉੰਨਾ ਹੀ ਵਧੀਆ ਲੱਗਦਾ ਹੈ ਕ੍ਰਿਕਟ ਮੈਂ ਜ਼ਿਆਦਾ ਦੇਖਦੀ ਹਾਂ ਬੈਡਮਿੰਟਨ ਬਹੁਤ ਜ਼ਿਆਦਾ ਖੇਡਿਆ ਵੀ ਹੈ ਅਤੇ ਬ ਬਾਸਕਿਟਬੋਲ ਮੈਂ ਆਪਣੇ ਸਕੂਲ ਲੈਵਲ 'ਤੇ ਬਹੁਤ ਜ਼ਿਆਦਾ ਖੇਡੀ ਹੈ ਜੋ ਕੀ ਇੱਕ ਬੰਦੇ ਨੂੰ ਫਿੱਟ ਐਨ ਫਾਇਨ ਰੱਖਦੀ ਹੈ ਗੇਮਸ ਅਤੇ ਬਾਕੀ ਵੀ ਮਸ਼ਹੂਰ ਜਿਹੜੀ ਸਾਡੀ ਇੰਡੀਆ ਦੀ ਕਹਿ ਲਓ ਮੇਨ ਨੈਸ਼ਨਲ ਜਿਹੜੀ ਉਹ ਗੇਮ ਹੈਗੀ ਆ ਖੇਡ ਹੈਗੀ ਉਹ ਹੋਬੀ ਉਹ ਹੈਗੀ ਆ ਹੋਕੀ ਹੈਗੀ ਹੈ ਅਤੇ ਉੱਦਾਂ ਵੀ ਸਾਰੀ ਗੇਮਸ ਮਸ਼ਹੂਰ ਹੈਗੀਆ ਅਤੇ ਮੇਨ ਜੋ ਸਾਡਾ ਇੰਟਰਸਟ ਹੈਗਾ ਕਿ ਕ੍ਰਿਕਟ ਦਾ ਉਹ ਬਹੁਤ ਵਧੀਆ ਹੈਗਾ